ਅੱਜ ਦਾ ਜੋ ਸਮਾਂ ਹੈ ਬਹੁਤ ਤਰੱਕੀ ਵਾਲਾ ਸਮਾਂ ਹੈ ਅਤੇ ਅਸੀਂ ਤਰੱਕੀ ਤਾਂਹੀਓ ਕਰ ਸਕਦੇ ਹਾਂ ਜੇ ਅਸੀਂ ਸਰੀਰ ਪ੍ਰਤੀ ਤੰਦਰੁਸਤ ਰਹਾਂਗੇ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਹਨ ਇਹ ਸਾਡੀ ਬਹੁਤ ਮਦਦ ਕਰਦੀਆਂ ਹਨ ਅਤੇ ਜਿਸ ਕਾਰਨ ਇਹ ਸਾਨੂੰ ਕਿੱਟਾਂ ਪ੍ਰੋਵਾਈਡ ਕਰਦੀਆਂ ਹਨ ਅਤੇ ਖੇਡ ਸੰਬੰਧੀ ਸਾਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਜਿਸ ਕਾਰਨ ਸਾਡੇ ਵਿੱਚ ਬਹੁਤ ਉਤਸ਼ਾਹ ਵੱਧਦਾ ਹੈ ਅਤੇ ਸਾਨੂੰ ਇਹ ਖਾਣ ਪੀਣ ਦਾ ਸਮਾਨ ਵੀ ਪ੍ਰੋਵਾਈਡ ਕਰਦੀਆਂ ਹਨ ਜਦੋਂ ਅਸੀਂ ਕਿਤੇ ਵੀ ਬਾਹਰੋਂ ਖੇਡਣ ਜਾਂਦੇ ਹਾਂ ਤਾਂ ਸਾਨੂੰ ਇਹ ਬਹੁਤ ਬੜੇ ਬੜੇ ਇਨਾਮ ਦਿੰਦੀਆਂ ਹਨ ਅਤੇ ਜਿਸ ਕਾਰਨ ਸਾਡੀ ਬਹੁਤ ਹੈਲਪ ਹੁੰਦੀ ਹੈ ਅਤੇ ਜਿਹੜੀਆਂ ਇਹ ਸੰਸਥਾਵਾਂ ਹਨ ਇਹ ਬਹੁਤ ਉੱਚੇ ਪੱਧਰ ਦੇ ਕੰਮ ਕਰਦੀਆਂ ਹਨ ਜਿਸ ਕਰਕੇ ਗਰੀਬ ਨੌਜਵਾਨ ਹਨ ਅਤੇ ਉਹਨਾਂ ਨੂੰ ਵੀ ਬਹੁਤ ਹੈਲਪ ਮਿਲਦੀ ਹੈ ਅਤੇ ਜੋ ਇਹ ਸੰਸਥਾਵਾਂ ਹਨ ਇਹ ਬਹੁਤ ਸਾਰੀਆਂ ਮਿਲਕੇ ਇਹ ਬਹੁਤ ਕੰਮ ਕਰਦੇ ਹਨ ਜਿ ਜਿਸ ਕਰਕੇ ਸਾਨੂੰ ਨੌਜਵਾਨਾਂ ਨੂੰ ਵੀ ਬਹੁਤ ਹੈਲਪ ਹੁੰਦੀ ਹੈ ਅਤੇ ਸਾਡੀ ਗੇਮ ਵਿੱਚ ਇਹ ਰੁਚੀ ਵਧਾਉਂਦੀਆਂ ਹਨ ਅਤੇ ਅਤੇ ਇਹ ਸਾਨੂੰ ਉਤਸ਼ਾਹਿਤ ਕਰਦੀਆਂ ਹਨ ਵੀ ਸਾਨੂੰ ਅੱਗੇ ਤੱਕ ਖੇਡਣਾ ਚਾਹੀਦਾ ਹੈ ਅਤੇ ਸਾਡੀ ਇਹ ਬਹੁਤ ਹੈਲਪ ਕਰਦੀਆਂ ਹਨ